ਹੈਲੋ ਸਰ ਮੈਂ ਕਰਮਜੀਤ ਸਿੰਘ ਗੱਲ ਕਰ ਰਿਹਾ ਮੈਂ ਤੁਹਾਡੀ ਸ਼ੌਪ 'ਤੇ ਜੋ ਵੀ ਸਮਾਨ ਮਿਲਦਾ ਉਹਦੇ ਬਾਰੇ ਪੁੱਛਣਾ ਚਾਹੁੰਦਾ ਜੀ ਹਾਂਜੀ ਜਿਵੇਂ ਤੁਹਾਡੀ ਦੁਕਾਨ 'ਤੇ ਔਨਲਾਈਨ ਸ਼ੋਅ ਹੁੰਦਾ ਵੀ ਫ਼ਰੂਟ ਵਗੈਰਾ ਦਾ ਸਾਰਾ ਕੁਛ ਮਿਲਦਾ ਅਤੇ ਮੈਂ ਇਹਦਾ ਰੇਟ ਵਗੈਰਾ ਅਤੇ ਕੁਆਲੀਟੀ ਵਗੈਰਾ ਬਾਰੇ ਪੁੱਛਣਾ ਚਾਹੁੰਦਾ

ਠੀਕ ਅਤੇ ਫਰੈਸ਼ ਫਰੂਟ ਫਰੈਸ਼ ਫਰੂਟ ਮਿਲਦਾ ਜੀ ਆਪਣੇ ਠੀਕ ਹੈ ਜੀ ਠੀਕ ਹੈ ਮਤਲਬ ਤੁਸੀਂ ਫਰੈਸ਼ ਔਰ ਵਧੀਆ ਫਰੂਟ ਹੀ ਹੈ ਤੁਹਾਡੇ ਕੋਲ ਤਾਂ ਹੀ ਥੋੜ੍ਹਾ ਜਿਹਾ ਰੇਟ ਵੀ ਤੁਹਾਡਾ ਹਾਈ ਹੈ ਜੀ ਠੀਕ ਹੈ ਤੁਹਾਡੇ ਕੋਲ ਇੱਕ ਹੀ ਤਰ੍ਹਾਂ ਦਾ ਫਰੂਟ ਹੈ ਮਤਲਬ ਜਿਕਣਾ ਬਨਾਨਾ 'ਚ ਇੱਕ ਹੀ ਟਾਇਪਸ ਦਾ ਜਾਂ ਅਲੱਗ ਅਲੱਗ ਬਨਾਨਾ ਵੀ ਉਹਦਾ ਰੇਟ ਵੀ ਅਲੱਗ ਅਲੱਗ ਹੈ ਅਤੇ ਜੇ ਆਪਾਂ ਨੇ ਮਤਲਬ ਫਰੂਟ ਔਨਲਾਈਨ ਮੰਗਵਾਉਣਾ ਹੋਵੇ ਤਾਂ ਤੁਹਾਡੇ ਕੋਲ ਮਤਲਬ ਕਿਹੜੀ ਕਿਹੜੀ ਫੈਸੀਲੀਟੀ ਅਵੇਲੇਬਲ ਹੈ ਚਲੋ ਠੀਕ ਹੈ ਜੀ ਥੈਂਕ ਯੂ ਤੁਹਾਡੀ ਜਾਣਕਾਰੀ ਮੈਨੂੰ ਬਹੁਤ ਵਧੀਆ ਲੱਗੀ ਜੀ ਥੈਂਕ ਯੂ